ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਈ ਅਭਿਨੇਤਰੀਆਂ ਨੂੰ ਦੇਖੀਦਾ ਹੈ ਕਿ ਉਹਨਾਂ ਨੇ ਬੜੇ ਹੀ ਸੋਹਣੇ ਸੋਹਣੇ ਨਵੇਂ ਨਵੇਂ ਸੂਟ ਪਾਏ ਹੁੰਦੇ ਨੇ ਅਤੇ ਕਈਆਂ ਦੀਆਂ ਫੋਟੋਆਂ ਹੀ ਅਖਬਾਰਾਂ 'ਚ ਆਉਂਦੀਆਂ ਨੇ ਇੱਦਾਂ ਹੀ ਕਰੀਨਾ ਕਪੂਰ ਦੀ ਇੱਕ ਵਾਰੀ ਇੱਕ ਫੋਟੋ ਆਈ ਜਿਸ ਵਿੱਚ ਉਸ ਨੇ ਇੱਕ ਮਜੰਟਾ ਕਲਰ ਦਾ ਸੂਟ ਪਾਇਆ ਹੋਇਆ ਸੀ ਉਹਦੇ ਉੱਤੇ ਕਾਲੇ ਰੰਗ ਦੀ ਪੱਟੀ ਲੱਗੀ ਹੋਈ ਸੀ ਜਿਸ ਵਿੱਚ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ ਅਤੇ ਮੈਨੂੰ ਉਹ ਸੂਟ ਬੜਾ ਹੀ ਪਸੰਦ ਆਇਆ ਮੈਨੂੰ ਅੱਜ ਵੀ ਯਾਦ ਹੈ ਇਹ ਤਕਰੀਬਨ ਅੱਜ ਤੋਂ ਅੱਠ ਤੋਂ ਨੌਂ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਉਹ ਸੂਟ ਬਣਵਾਇਆ ਸੀ ਔਰ ਉਹ ਸੂਟ ਮੈਂ ਆਪਣੀ ਸਹੇਲੀ ਦੇ ਵਿਆਹ 'ਚ ਪਾਇਆ ਸੀ ਮਜੰਟਾ ਕਲਰ ਦਾ ਸੂਟ ਉਹਦੇ ਉੱਤੇ ਵੈਲਵੈਟ ਦੀ ਕਾਲੇ ਰੰਗ ਦੀ ਪੱਟੀ ਸੀ ਜਿਹੜੀ ਬਾਵਾਂ 'ਤੇ ਵੀ ਬੜੀ ਚੌੜੀ ਪੱਟੀ ਸੀ ਇੱਦਾਂ ਲੱਗਦਾ ਸੀ ਜਿਵੇਂ ਚੂੜੀਆਂ ਪਾਈਆਂ ਹੋਣ ਮੁਸ਼ਕਿਲਾਂ ਮੈਨੂੰ ਇੰਨੀਆਂ ਆਈਆਂ ਉਸ ਸੂਟ ਨੂੰ ਬਣਵਾਉਣ ਲਈ ਕਿਉਂਕਿ ਉਸ ਦਾ ਘੇਰਾ ਬਹੁਤ ਜ਼ਿਆਦਾ ਸੀ ਔਰ ਕੱਪੜਾ ਘੱਟ ਤੋਂ ਘੱਟ ਵੀ ਛੇ ਮੀਟਰ ਇਕੱਲੀ ਹੀ ਕਮੀਜ਼ ਨੂੰ ਲੱਗਾ ਸੀ ਔਰ ਉਸ ਤੋਂ ਬਾਅਦ ਜਦੋਂ ਕਮੀਜ਼ ਲ ਤਾਂ ਸਭ ਤੋਂ ਜ਼ਿਆਦਾ ਮੈਨੂੰ ਔਖਿਆਈ ਆਈ ਉਹਦੀ ਸਵਾਈ ਦੇਣ ਵਾਸਤੇ ਕਿਉਂਕਿ ਉਹ ਸੂਟ ਦਾ ਫੈਰਾਵ ਏਡਾ ਸੀ ਔਰ ਮੇਰਾ ਹੱਥ ਉਸ ਸਮੇਂ ਸਿਲਾਈ ਦੇ ਵਿੱਚ ਇੰਨਾ ਜ਼ਿਆਦਾ ਖੁੱਲਿਆ ਨਹੀਂ ਹੋਇਆ ਸੀ ਕਿ ਮੈਂ ਉਹ ਸੂਟ ਆਪੇ ਸੀ ਸਕਾਂ ਲੇਕਿਨ ਉਹ ਸੂਟ ਮੈਂ ਆਪਣੇ ਇੱਕ ਜਾਣਕਾਰ ਤੋਂ ਸਿਲਵਾਇਆ ਜਿਸ ਨੇ ਮੇਰੇ ਕੋਲੋਂ ਉਸ ਟਾਈਮ 'ਤੇ ਪੰਦਰ੍ਹਾਂ ਸੌ ਰੁਪਏ ਸਵਾਈ ਲਿਤੀ ਜਿਹੜੀ ਕਿ ਮੈਨੂੰ ਚੁਬੀ ਤਾਂ ਬੜੀ ਲੇਕਿਨ ਮੈਨੂੰ ਸਭ ਤੋਂ ਜ਼ਿਆਦਾ ਮੁਸ਼ਕਿਲ ਇਹ ਵੀ ਲੱਗੀ ਕਿ ਮੈਂ ਇਹ ਸੂਟ ਪਾਉਣਾ ਤਾਂ ਹੈ ਪਰ ਮੈਂ ਸਵਾਈ ਦੇਣ 'ਚ ਫਿਰ ਗੁਰੇਜ਼ ਜੀ ਨਹੀਂ ਕੀਤੀ ਥੋੜ੍ਹਾ ਜਿਹਾ ਦੁੱਖ ਲੱਗਾ ਬਟ ਮੈਂ ਫਿਰ ਵੀ ਉਹ ਸੂਟ ਸਵਾਇਆ ਪਰ ਉਹ ਸੂਟ ਬਹੁਤ ਸੋਹਣਾ ਬਣਿਆ ਸੀ ਧੰਨਵਾਦ